ਮੈਂ ਪਿਛਲੇ ਮਹੀਨੇ ਟੀ ਵੀ ਮੰਗਵਾਇਆ ਸੀਗਾ ਐਮਾਜ਼ੋਨ ਤੋਂ ਮੰਗਵਾਇਆ ਸੀ ਅਤੇ ਘਰ ਦੇ ਮੇਰੇ ਤਾਂ ਮੈਨੂੰ ਰੋਕਦੇ ਸੀਗੇ ਕਿ ਰਹਿਣ ਦੇ ਵੀ ਕਿ ਪਹਿਲਾਂ ਅਸੀਂ ਮੰਗਵਾਇਆ ਸੀਗਾ ਫੋਨ ਸੈਮਸੰਗ ਦਾ ਮੰਗਵਾਇਆ ਸੀਗਾ ਉਹ ਪਲੇ ਉਹਦਾ ਨਿਕਲਿਆ ਨੋਕੀਏ ਦਾ ਜੀ ਅਤੇ ਉਹ ਵੀ ਖਰਾਬ ਸੀਗਾ ਅਤੇ ਨਾ ਕੋਈ ਚੱਲਦਾ ਸੀਗਾ ਅਤੇ ਇਸ ਕਰਕੇ ਘਰ ਦੇ ਤਾਂ ਰੋਕਦੇ ਸੀਗੇ ਵੀ ਰਹਿਣ ਦੇ ਵੀ ਆਪਾਂ ਸੋਡੀ ਤੋਂ ਲਿਆਉਂਦੇ ਆ ਨਾਲੇ ਚਲੋ ਕਿਸ਼ਤਾਂ ਕਰਲਾਂਗੇ ਉਹਦੇ ਅਤੇ ਥੋੜ੍ਹਾ ਜਿਹਾ ਪਰ ਮੈਂ ਤਾਂ ਕਿਹਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਇੱਕ ਵਾਰ ਚੀਜ਼ ਖਰਾਬ ਨਿਕਲਦੀ ਆ ਹਰੇਕ ਵਾਰ ਥੋੜ੍ਹੀ ਨਿਕਲਦੀ ਆ ਅਤੇ ਚੱਲ ਮੈਂ ਕਿਹਾ ਵੀ ਇਹ 'ਤੇ ਦੇਖ ਲੈਂਦੇ ਹਾਂ ਅਤੇ ਦਿਵਾਲੀ ਦਾ ਮੌਕਾ ਸੀਗਾ ਥੋੜ੍ਹੇ ਔਫਰ ਲੱਗੇ ਹੋਏ ਸੀਗੇ ਉਹਦੇ ਕਰਕੇ ਫਿਰ ਮੈਂ ਦੇਖਿਆ ਮੈਂ ਟੀ ਵੀ ਪਹਿਲਾਂ ਦੇਖਿਆ ਮੈਂ ਟੀ ਵੀ ਲੱਗਿਆ ਮੈਨੂੰ ਐੱਲ ਜੀ ਦਾ ਵਧੀਆ ਸੀਗਾ ਉਹ ਅਤੇ ਨਾਲ ਉਹਨਾਂ ਨੇ ਵਧੀਆ ਛੂਟ ਦਿੱਤੀ ਹੋਈ ਸੀਗੀ ਡਿਸਕਾਊਂਂਟ ਸੀਗਾ ਅਤੇ ਨਾਲ ਉਨ੍ਹਾਂ ਨੇ ਹੋਮ ਥੇਟਰ ਵੀ ਫਰੀ ਦਿੱਤੇ ਸੀਗੇ ਲਿਖੇ ਵੀ ਸੀ ਨਾਲ ਚਲੋ ਫਿਰ ਮੈਂ ਔਡਰ ਕਰ ਲਿਆ ਔਡਰ ਕਰਿਆ ਦੋ ਤਿੰਨ ਦਿਨਾਂ ਦੇ ਵਿੱਚ ਆ ਗਿਆ ਮੇਰੇ ਕੋਲ ਆਇਆ ਹੋਇਆ ਉਹਤੋਂ ਬਾਅਦ ਮੈਂ ਚਲੋ ਮੈਂ ਘਰ ਮੈਂ ਦੇਖਿਆ ਮੈਂ ਹੋਮ ਥੇਟਰ ਵੀ ਵਧੀਆ ਸੀਗਾ ਸੋਨੀ ਦੇ ਹੈਗੇ ਸੀਗੇ ਅਤੇ ਜਿਹੜੀ ਟੀ ਵੀ ਸੀਗਾ ਟੀ ਵੀ ਸਲਾਬ ਨੂੰ ਇਹ ਕਹਿੰਦੇ ਫੜਦੀ ਨਹੀਂ ਹੈਗਾ ਇਹ ਵੀ ਵਧੀਆ ਟੀ ਵੀ ਆ ਅਤੇ ਉਹਦੇ ਨਾਲ ਮੈਂ ਟਾਰ ਤਾਰ ਦੇਖੀ ਮੈਂ ਤਾਰ ਵੀ ਵਧੀਆ ਲੰਬੀ ਸੀਗੀ ਅਤੇ ਹੋਮ ਥੇਟਰ ਸੀਗੇ ਉਹ ਵੀ ਮੈਂ ਨਾਲ ਹੀ ਲਾ ਲਏ ਉਹਨਾਂ ਦੀ ਤਾਰ ਵਧੀਆ ਲੰਬੀ ਸੀਗੀ ਅਤੇ ਵਧੀਆ ਨੇ ਅਤੇ ਮੈਨੂੰ ਜਦੋਂ ਮੈਂ ਚਲਾ ਕੇ ਦੇਖਿਆ ਹੈ ਵੀ ਵਧੀਆ ਕੁਆਲਿਟੀ ਵੀ ਵਧੀਆ ਸਕਰੀਨ ਦੀ ਕੁਆਲਿਟੀ ਵੀ ਬਹੁਤ ਵਧੀਆ ਲੱਗੀ